ਹੈਲੋ ਹਾਂਜੀ ਕਿਆ ਹਾਲ ਹੈ ਬਾਈ ਜੀ ਹਾਂਜੀ ਹਾਂਜੀ ਐਨ ਵਧੀਆ ਹੋਰ ਪਛਾਣ ਲਿਆ ਤੁਸੀਂ ਧੰਨ ਭਾਗ ਸਾਡੇ ਜੇ ਪਛਾਣ ਲਿਆ ਤੁਸੀਂ ਇੰਨੇ ਚਿਰ ਮਗਰੋਂ ਕੌਲ ਬਾਈ ਐ ਕਰੀ ਓ ਨਹੀਂ ਤੁਸੀਂ ਯਾਰ ਉਏ ਨਾ ਨਾ ਮਹਾਰਾਜ ਅਸੀਂ ਤਾਂ ਰੋਜ਼ ਯਾਦ ਕਰਦੇ ਹਾਂ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਐਨ ਸਭ ਵਧੀਆ ਤੁਸੀਂ ਸੁਣਾਓ ਘਰ ਕਿੱਦਾਂ ਬਾਲ ਬੱਚੇ ਹੋਰ ਭਾਬੀ ਜੀ ਠੀਕ ਆ ਹਾਂਜੀ ਹਾਂਜੀ ਐਨ ਇੱਧਰ ਵੀ ਸਭ ਰਾਜ਼ੀ ਖੁਸ਼ੀ ਹੋਈ ਹਾਂਜੀ ਹਾਂਜੀ ਸਭ ਠੀਕ ਹੈ ਜੀ ਹਾਂਜੀ ਨਾ ਉਹ ਕੰਮ ਤਾਂ ਕੋਈ ਨਹੀਂ ਬਾਈ ਜੀ ਬਸ ਉੱਦਾਂ ਹੀ ਮੈਂ ਕਿਹਾ ਮਾੜਾ ਜਿਹਾ ਛੋਟਾ ਜਿਹਾ ਕੰਮ ਥਾ ਇੱਕ ਹਾਂਜੀ ਐਕਚੁਲੀ ਨਾ ਤੁਸੀਂ ਦੇਖਿਆ ਮੇਰੇ ਵਾਲਾ ਸਪਲੈਂਡਰ ਜਿਹੜਾ ਮੋਟਰਸਾਈਕਲ ਹਾਂਜੀ ਉਹਦਾ ਨਾ ਉਹ ਕਰਵਾਉਣਾ ਸੀਗਾ ਜੀ ਆਪਾਂ ਪੋਲਿਊਸ਼ਨ ਦਾ ਪੀ ਯੂ ਸੀ ਸਰਟੀਫਿਕੇਟ ਬਣਵਾਉਣਾ ਥਾ ਹਾਂਜੀ ਮੈਂ ਕਿਹਾ ਚਲੋ ਤੁਹਾਨੂੰ ਜ਼ਿਆਦਾ ਪਤਾ ਹੋਣਾ ਤੁਹਾਨੂੰ ਪੁੱਛ ਲਈਏ ਹਾਂਜੀ ਹਾਂਜੀ ਮੈਂ ਗਿਆ ਸੀਗਾ ਜੀ ਉੱਥੇ ਹਾਂ ਮੈਂ ਸਾਰੀਆਂ ਫੋਰਮੈਲਿਟੀਜ਼ ਪੂਰੀਆਂ ਕਰਤੀਆਂ ਜੀ ਮੈਂ ਉਹ ਪੁੱਛਣਾ ਸੀਗਾ ਜੀ ਅੱਗੇ ਦਾ ਪ੍ਰੋਸੀਜਰ ਕਿਆ ਹੈ ਜੀ ਉਹਦਾ ਕਦੋਂ ਤੱਕ ਬਣ ਕੇ ਆ ਜਾਊਗਾ ਜੀ ਕਿਆ ਕਿਆ ਮੈਨੂੰ ਹੋਰ ਜਮ੍ਹਾਂ ਕਰਵਾਉਣਾ ਪਊਗਾ ਠੀਕ ਹੈ ਜੀ ਅੱਛਾ ਜੀ ਹਾਂ ਮੇਰੇ ਕੋਲ ਹੈਗੇ ਆ ਜੀ ਕੋਈ ਨਹੀਂ ਕਰਵਾ ਦੂੰਗਾ ਮੈਂ ਹਾਂਜੀ ਅੱਛਾ ਜੀ ਹਾਂਜੀ ਚਲੋ ਠੀਕ ਆ ਭਾਅ ਜੀ ਅੱਛਾ ਜੀ ਅੱਛਾ ਠੀਕ ਹੈ ਜੀ